ਪੰਜਾਬ ਵਿੱਚ ਕਈ ਸੱਭਿਆਚਾਰਕ ਧਾਰਮਿਕ ਤਿਉਹਾਰ ਮਨਾਏ ਜਾਂਦੇ ਹਨ ਕਈ ਖੇਡ ਸਮਾਗਮ ਹੁੰਦੇ ਹਨ ਜਿਹੜੇ ਕਿ ਪੰਜਾਬ ਦੀ ਸੱਭਿਆਚਾਰਿਕ ਏਕਤਾ ਨੂੰ ਦਰਸਾਉਂਦੇ ਹਨ ਅਤੇ ਪੰਜਾਬ ਵਿੱਚ ਰਹਿੰਦੇ ਭਿੰਨ ਭਿੰਨ ਭਾਈਚਾਰੇ ਦੀ ਆਪਸੀ ਏਕਤਾ ਨੂੰ ਦਰਸਾਉਂਦੇ ਹਨ ਇੱਥੇ ਜਨਮਸ਼ਟਮੀ ਹੋਲਾ ਮਹੱਲਾ ਦੁਸਹਿਰਾ ਹੋਲੀ ਆਦਿ ਕਈ ਤਿਉਹਾਰ ਮਨਾਏ ਜਾਂਦੇ ਹਨ ਜਨਮਸ਼ਟਮੀ ਦਾ ਤਿਉਹਾਰ ਤਾਂ ਸਾਰੇ ਹੀ ਪੰਜਾਬੀ ਬੜੀ ਧੂਮਧਾਮ ਨਾਲ ਮਨਾਉਂਦੇ ਹਨ ਮੰਦਰਾਂ ਨੂੰ ਸਜਾ ਸਜਾਇਆ ਜਾਂਦਾ ਹੈ ਸਾਰੇ ਭਾਈਚਾਰੇ ਦੇ ਲੋਕ ਉਸ ਦਿਨ ਮੰਦਰਾਂ 'ਚ ਜਾਂਦੇ ਹਨ ਹੋਲੇ ਮਹੱਲੇ ਦਾ ਤਿਉਹਾਰ ਵੀ ਲੋਕ ਵਹੀਰਾਂ ਘੱਤ ਕੇ ਅਨੰਦਪੁਰ ਸਾਹਿਬ ਜਾਂਦੇ ਹਨ ਅਤੇ ਸਭ ਧਰਮਾਂ ਦੇ ਲੋਕ ਬੜੀ ਸ਼ਰਧਾ ਨਾਲ ਮਨਾਉਂਦੇ ਹਨ ਇਸੇ ਤਰ੍ਹਾਂ ਦੁਸਹਿਰਾ ਵੀ ਸਾਰੇ ਭਾਈਚਾਰੇ ਵੱਲੋਂ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਅਤੇ ਇਹ ਸਾਡੇ ਆਪਸੀ ਭਾਈਚਾਰੇ ਨੂੰ ਦਰਸਾਉਂਦਾ ਹੈ